ਸ਼ੇਅਰ ਮਾਰਕੀਟ ਬਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਪਰ ਜਿੰਨੀ ਕੁ ਹੈਗੀ ਆ ਮੈਨੂੰ ਉਹ 'ਚ ਇਹ ਹੀ ਹੈ ਵੀ ਸ਼ੇਅਰ ਮਾਰਕੀਟ 'ਚ ਲੋਕ ਆਪਣਾ ਜਿਵੇਂ ਪੈਸਾ ਇੰਨਵੈਸਟ ਕਰ ਲੈਂਦੇ ਹੈ ਅਤੇ ਉਹ 'ਚ ਹੁਣ ਕਈ ਵਾਰ ਤੁਸੀਂ ਇੰਨਵੈਸਟ ਕੀਤਾ ਹੁੰਦਾ ਤੁਸੀ ਰਾਤੋ ਰਾਤ ਮਾਲਾ ਮਾਲ ਬਣਨ ਵਾਲੀ ਗੱਲ ਹੋ ਜਾਂਦੀ ਅਤੇ ਕਈ ਵਾਰੀ ਤੁਹਾਡੇ ਡੁੱਬ ਵੀ ਜਾਂਦੇ ਆ ਜਾਂ ਕਈ ਲੋਕ ਸ਼ੇਅਰ ਲੈ ਕੇ ਰੱਖ ਲੈਂਦੇ ਕਿਸੇ ਕੰਪਨੀ ਦੇ ਥੋੜ੍ਹੇ ਟਾਈਮ ਮਤਲਬ ਵੀ ਕਾਫ਼ੀ ਕਾਫ਼ੀ ਸਾਲ ਉਹਨਾਂ ਕੋਲ ਪਏ ਰਹਿੰਦੇ ਆ ਅਚਾਨਕ ਉਹਨਾ ਦੀਆਂ ਕੀਮਤਾਂ ਜੋ ਉਛਾਲ ਆ ਜਾਂਦਾ ਉਹਨਾ ਦਾ ਫ਼ਾਇਦਾ ਵੀ ਹੋ ਜਾਂਦਾ ਹੈਗਾ ਮਤਲਬ ਸ਼ੇਅਰ ਮਾਰਕੀਟ ਇੱਕ ਜੂਏ ਵਾਲਾ ਹਿਸਾਬ ਈ ਲਗਾਓ ਵੀ ਥੋ ਤੁਸੀਂ ਲਗਾਏ ਆ ਪੈਸੇ ਤਾਂ ਹੋ ਸਕਦਾ ਤੁਹਾਨੂੰ ਉਸ ਵਿੱਚ ਬਹੁਤ ਲਾਭ ਵੀ ਮਿਲ ਜਾਵੇ ਅਤੇ ਇਹ ਵੀ ਹੋ ਸਕਦਾ ਕਿ ਤੁਹਾਨੂੰ ਹਾਨੀ ਵੀ ਹੋ ਜਾਵੇ ਇਸ ਕਰਕੇ ਇਹਦੇ ਬਾਰੇ ਕੁਛ ਜ਼ਿਆਦਾ ਕਿਹਾ ਨਹੀ ਜਾ ਸਕਦਾ ਖ਼ਤਰਨਾਕ ਵੀ ਹੈਗਾ ਕਿਉਂਕਿ ਕਈ ਵਾਰ ਬੰਦਾ ਕਿਸੇ ਮਗਰ ਲੱਗ ਕੇ ਸਾਰਾ ਘਰ ਬਾਰ ਹੀ ਆਪਣਾ ਚੁੱਕ ਕੇ ਉੱਤੇ ਕਰਜ਼ਾ ਚੁੱਕ ਕੇ ਵੀ ਲਗਾ ਦਿੰਦਾ ਵੀ ਚੱਲ ਮੈਨੂੰ ਪੈਸੇ ਬਣ ਜਾਣਗੇ ਪਰ ਕਈ ਵਾਰੀ ਇਹਦਾ ਉਲਟਾ ਵੀ ਰਿਜਲਟ ਹੋ ਜਾਂਦਾ ਕਿ ਉਹ ਤੁਹਾਡੇ ਪੈਸੇ ਹੋ ਸਕਦਾ ਡੁੱਬ ਵੀ ਜਾਣ